ਲੇਖਕ ਪੰਜਾਬੀ ਭਾਸ਼ਾ ਦੀ ਵਰਤੋਂ ਕਿਤਾਬਾਂ ਲਿਖਣ ਵਿੱਚ ਸਾਹਿਤ ਦੀ ਕਲਾ ਨੂੰ ਦਰਸਾਉਣ ਲਈ ਕਵਿਤਾ ਦੁਆਰਾ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕਰਦੇ ਹਨ